ਕੀ ਤੁਹਾਡੇ ਕੋਲ ਤੁਹਾਡੇ ਦੁਆਰਾ ਬਣਾਈ ਗਈ ਕਿਸੇ ਖਾਸ ਪੇਂਟਿੰਗ ਬਾਰੇ ਕੋਈ ਯਾਦਗਾਰ ਕਹਾਣੀਆਂ ਜਾਂ ਕਿੱਸੇ ਹਨ ਜੀ ਹਾਂ ਮੇਰੇ ਕੋਲ ਮੇਰੇ ਦੁਆਰਾ ਬਣਾਈ ਗਈ ਖਾਸ ਪੇਂਟਿੰਗ ਅਤੇ ਕਈ ਯਾਦਗਾਰ ਕਹਾਣੀਆਂ ਦੇ ਕਿੱਸੇ ਹਨ ਜਿਸ ਨੂੰ ਮੈਂ ਬਹੁਤ ਵਾਰ ਆਪਣੇ ਯਾਦਾਂ ਦੇ ਵਿੱਚ ਯਾਦ ਕਰਦੀ ਹਾਂ ਅਤੇ ਉਸ ਦਾ ਆਨੰਦ ਲੈਂਦੀ ਹਾਂ ਆਪਣੇ ਬਚਪਨ ਦੇ ਵਿੱਚ ਮੈਨੂੰ ਪੇਟਿੰਗ ਕਰਨਾ ਬਹੁਤ ਪਸੰਦ ਸੀ ਮੈਂ ਕਿਸੇ ਵੀ ਵਿਹਲੇ ਟਾਈਮ ਦੇ ਵਿੱਚ ਪੇਂਟਿੰਗ ਅਤੇ ਆਪਣੇ ਰੰਗਾਂ ਆਪਣੇ ਰੰਗਾਂ ਆਪਣੇ ਡਰਾਇੰਗ ਸ਼ੀਟਸ ਆਪਣੀ ਪੇਂਟਿੰਗ ਸ਼ੀਟਸ ਦੇ ਨਾਲ ਬਹੁਤ ਆਨੰਦ ਮਾਨਦੀ ਸੀ ਮੈਨੂੰ ਸਭ ਤੋਂ ਦੂਰ ਹੋ ਕੇ ਵੀ ਆਪਣੀ ਪੇਂਟਿੰਗਸ ਦੇ ਨਜ਼ਦੀਕ ਰਹਿਣਾ ਪਸੰਦ ਸੀ ਮੈਂ ਆਪਣੇ ਘਰ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਪੇਂਟਿੰਗਸ ਬਣਾ ਕੇ ਲਗਾਈਆਂ ਸੀ ਅਤੇ ਮੈਨੂੰ ਆਪਣੇ ਕਰੀਬੀਆਂ ਨੂੰ ਆਪਣੀਆਂ ਪੇਂਟਿੰਗਸ ਦਾ ਪੇਂਟ ਕਰਨਾ ਬਹੁਤ ਪਸੰਦ ਸੀ ਅੱਜ ਵੀ ਮੇਰੀਆਂ ਪੇਂਟਿੰਗਸ ਮੇਰੇ ਪਰਿਵਾਰਾਂ ਦੇ ਘਰਾਂ ਦੇ ਵਿੱਚ ਲੱਗੀਆਂ ਹੋਈਆਂ ਹਨ